ਭਾਰਤ ਦਾ ਫ਼ੈਸ਼ਨ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਪਹਿਲਾਂ ਦੇ ਸਮੇਂ ਵਿੱਚ ਲੋਕਾਂ ਦੇ ਕੱਪੜੇ ਬਹੁਤ ਹੀ ਵਧੀਆ ਹੁੰਦੇ ਸਨ ਲੋਕ ਪਿਛਲੇ ਜ਼ਮਾਨੇ ਵਿੱਚ ਕੁੜਤੇ ਪਜਾਮੇ ਪਾਉਂਦੇ ਸਨ ਉੱਥੇ ਹੀ ਦੂਸਰੇ ਬੰਨੇ ਧੀਆਂ ਪੂਰੀ ਸਲਵਾਰ ਕਮੀਜ਼ ਪਾ ਕੇ ਸਿਰ ਨੂੰ ਚੌਵੀ ਘੰਟੇ ਢੱਕ ਕੇ ਰੱਖਦੀਆਂ ਸਨ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਇਹ ਚੀਜ਼ਾਂ ਬਹੁਤ ਹੀ ਬਦਲ ਗਈਆਂ ਹਨ ਪੱਛਮੀ ਦੇਸ਼ਾਂ ਦਾ ਪ੍ਰਭਾਵ ਭਾਰਤ ਉੱਤੇ ਬਹੁਤ ਹੀ ਜ਼ਿਆਦਾ ਪੈ ਰਿਹਾ ਹੈ ਜਿੱਥੇ ਪੱਛਮੀ ਦੇਸ਼ਾਂ ਵਿੱਚ ਕੁੜੀਆਂ ਅੱਧੇ ਪਛੱਧੇ ਕੱਪੜੇ ਪਾਉਂਦੀਆਂ ਹਨ ਅਤੇ ਆਪਣਾ ਅੰਗ ਪ੍ਰਦਰਸ਼ਨ ਕਰਦੀਆਂ ਹਨ ਉੱਥੇ ਹੀ ਭਾਰਤ ਦੀਆਂ ਕੁੜੀਆਂ ਵੀ ਇਹ ਸਭ ਕਰਨ ਲੱਗ ਚੁਕੀਆਂ ਹਨ ਜਿੱਥੇ ਪਹਿਲਾਂ ਮੁੰਡੇ ਕੁੜਤਾ ਪਜਾਮਿਆਂ ਨੂੰ ਪਾਉਂਦੇ ਸਨ ਉੱਥੇ ਅੱਜ ਕੱਲ੍ਹ ਦੇ ਮੁੰਡੇ ਜੀਨ ਸ਼ਲਟਾਂ ਪਾਉਣ ਲੱਗ ਪਏ ਹਨ ਪਿੰਡਾਂ ਥਾਵਾਂ ਵਿੱਚ ਅਜੇ ਵੀ ਇਹ ਫੈਸ਼ਣ ਦਾ ਦੌਰ ਪੂਰੀ ਤਰ੍ਹਾਂ ਨਹੀਂ ਆਇਆ ਹੈ ਪਰੰਤੂ ਪਰ ਫੈਸ਼ਨ ਦਾ ਦੌਰ ਇਹ ਪੂਰੀ ਤਰ੍ਹਾਂ ਆ ਚੁੱਕਾ ਹੈ ਸ਼ਹਿਰਾਂ ਵਿੱਚ ਇਹ ਫ਼ੈਸ਼ਨ ਦਾ ਦੌਰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ ਪਹਿਲਾਂ ਜਿੱਥੇ ਕੁੜੀਆਂ ਸਾਧਾਰਨ ਕੱਪੜੇ ਜ਼ਿਆਦਾ ਪਾਉਂਦੀਆਂ ਸਨ ਅੱਜ ਕੱਲ੍ਹ ਉਹੀ ਕੁੜੀਆਂ ਚੁੰਨੀ ਲੈਣਾ ਵੀ ਠੀਕ ਨਹੀਂ ਸਮਝਦੀਆਂ ਇਹ ਸਾਰਾ ਕੁਛ ਇਸਟਾਗ੍ਰਾਮ ਫੇਸਬੁੱਕ ਯੂਟਿਊਬ ਉੱਤੇ ਕੁੜੀਆਂ ਆਪਣੇ ਕੱਪੜਿਆਂ ਨੂੰ ਵਿਖਾ ਵਿਖਾ ਕੇ ਬਦਲਦੀਆਂ ਹਨ ਅਤੇ ਉਹ ਬਹੁਤ ਹੀ ਜ਼ਿਆਦਾ ਮਸ਼ਹੂਰ ਹੁੰਦੀਆਂ ਹਨ ਜਿੱਥੇ ਕਿ ਇਹ ਫ਼ੈਸ਼ਨ ਤੁਹਾਨੂੰ ਦੱਸਦਾ ਹੈ ਕਿ ਭਾਰਤ ਪਹਿਲਾਂ ਨਾਲੋਂ ਕਿੰਨਾ ਬਦਲ ਚੁੱਕਾ ਹੈ ਉੱਥੇ ਹੀ ਦੂਸਰੇ ਬੰਨੇ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਡਾ ਦੇਸ਼ ਪਹਿਲਾਂ ਕਿਹੋ ਜਿਹਾ ਸੀ ਅਤੇ ਹੁਣ ਕਿਹੋ ਜਿਹਾ ਹੈ ਮੈਂ ਆਪਣੇ ਕੱਪੜੇ ਬਹੁਤ ਹੀ ਸਾਧਾਰਨ ਪਾਉਂਦਾ ਹਾਂ ਮੈਂ ਬਹੁਤੇ ਫ਼ੈਸ਼ਨ ਜ਼ਿਆਦਾ ਨਹੀਂ ਕਰਦਾ ਹਾਂ ਮੈਂ ਉਹਨਾਂ ਨੂੰ ਆਪਣੇ ਲਾਗੋਂ ਸ਼ਾਗੋਂ ਹੀ ਖਰੀਦਦਾ ਹਾਂ ਜਿਸ ਕਾਰਨ ਮੈਨੂੰ ਲੋਕ ਜਾਣਦੇ ਹਨ ਅਤੇ ਉਹ ਮੈਨੂੰ ਸ ਛੂਟ ਵੀ ਕੱਪੜਿਆਂ 'ਤੇ ਦੇ ਦਿੰਦੇ ਹਨ ਇਸ ਕਰਕੇ ਮੈਂ ਜ਼ਿਆਦਾ ਫ਼ੈਸ਼ਨ ਦੇ ਵਿੱਚ ਰੁਚੀ ਨਹੀਂ ਰੱਖਦਾ